ਇੱਕ ਲੇਖਕ ਨੂੰ ਲਿਖਣ ਵਾਸਤੇ ਸਭ ਤੋਂ ਪਹਿਲਾਂ ਉਹਨੂੰ ਆਪਣੇ ਵਿਸ਼ੇ ਦੀ ਬਹੁਤ ਸਾਰੀ ਜਾਣਕਾਰੀ ਦਾ ਹੋਣਾ ਬਹੁਤ ਜ਼ਰੂਰੀ ਹੈ ਦੂਸਰਾ ਉਸ ਲਿਖਤ ਬਾਰੇ ਜੋ ਵੀ ਉਸਨੇ ਲਿਖਣਾ ਹੈ ਉਹਦੇ 'ਤੇ ਉਸਦੀ ਮਜ਼ਬੂਤ ਪਕੜ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਮੈਂ ਅਕਸਰ ਜ਼ਿਆਦਾ ਨਹੀਂ ਲਿਖਦਾ ਬਿਲਕੁਲ ਥੋੜ੍ਹੇ ਬਹੁਤ ਆਪਣੀ ਨਿੱਜੀ ਸ਼ਾਇਰੀ ਲਿਖਦਾ ਹਾਂ ਜਿਹਦੇ ਵਿੱਚ ਆਮ ਵਿਸ਼ੇ ਨਾਲ ਸੰਬੰਧਤ ਹੀ ਲਿਖਦਾ ਹਾਂ ਔਰ ਉਹਨਾਂ ਨੂੰ ਮੈਂ ਜਿਹਨਾਂ ਨੂੰ ਵੀ ਆਪਣੀ ਫੀਡ ਸਟੋਰੀਜ਼ ਜਾਂ ਜੋ ਵੀ ਆਪਣੀਆਂ ਸ਼ੇਅਰਸ ਅ ਵਗੈਰਾ ਸੁਣਾਏ ਹਨ ਉਹਨਾਂ ਦਾ ਮੈਨੂੰ ਅੱਛਾ ਫੀਡਬੈਕ ਮਿਲਿਆ ਹੈ ਕੋਈ ਹਰ ਜਗ੍ਹਾ ਤੋਂ ਉਹਦਾ ਬਹੁਤ ਵਧੀਆ ਸਮਰਥਨ ਹੀ ਕੀਤਾ ਗਿਆ ਹੈ ਬਾਕੀ ਹੋਰ ਲੇਖਕਾਂ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਜੋ ਵੀ ਉਹ ਆਪਣੇ ਲਿਖਦੇ ਹਨ ਜਿਸ ਤਰ੍ਹਾਂ ਅਖ਼ਬਾਰ 'ਤੇ ਲਿਖਣੀ ਹੈ ਜਾਂ ਜੋ ਅਲੱਗ ਅਲੱਗ ਵਿਸ਼ਿਆਂ ਦੇ ਨਾਲ ਸੰਬੰਧਤ ਲਿਖਤਾਂ ਲਿਖੀਆਂ ਜਾਂਦੀਆਂ ਹਨ ਉਹਨਾਂ 'ਤੇ ਉਹਨਾਂ ਦੀ ਸਮਝ ਬੂਝ ਅਨੁਸਾਰ ਹੀ ਉਹਨਾਂ ਨੂੰ ਲਿਖਣਾ ਚਾਹੀਦਾ ਹੈ ਜਾਂ ਕਿ ਜੋ ਲਿਖਤ ਵੀ ਲਿਖਣ ਉਹ ਸਮਾਜ 'ਤੇ ਉਹਦਾ ਅੱਛਾ ਅਸਰ ਪਵੇ